ਨਵੇਂ ਪਕਵਾਨਾਂ ਨਵੇਂ ਪਕਵਾਨ ਜੇਕਰ ਦੇ ਸਿੱਖਣ ਦੇ ਲਈ ਸ ਅਸੀਂ ਵੈਸੇ ਤਾਂ ਬਹੁਤ ਸਾਰੀਆਂ ਟੀ ਵੀ ਦੇ ਉੱਤੇ ਸ਼ ਸ਼ੋਅ ਆਉਂਦੇ ਨੇ ਯੂਟਿਊਬ ਆਉਂਦੀਆਂ ਜਿਹੜੀਆਂ ਵੀਡੀਓਸ ਨੇ ਲੋਕਾਂ ਨੇ ਬਹੁਤ ਪਾਈਆਂ ਹੁੰਦੀਆਂ ਯੂਟਿਊਬ 'ਤੇ ਪਰ ਜਿਹੜਾ ਇੱਕ ਹੋਰ ਜ਼ਰੀਆ ਹੈ ਟੀ ਵੀ ਦੇ ਵਿੱਚ ਉਹ ਰਸੋਈਆ ਬਣਨ ਦੇ ਲਈ ਪ੍ਰੋਗਰਾਮ ਆਉਂਦਾ ਹੈ ਉੱਥੇ ਉਹਨਾਂ ਨੂੰ ਦੇਖ ਕੇ ਅਸੀਂ ਪ੍ਰੇਰਿਤ ਹੋ ਕੇ ਬਹੁਤ ਸਾਰੀਆਂ ਰੈਸੇਪੀਜ਼ ਜਿਹੜੀਆਂ ਨੇ ਉਹ ਸਿੱਖ ਸਕਦੇ ਨੇ